ਸਕੂਲ ਵਿਦਿਆਰਥੀਆਂ ਨੂੰ ਕਲਾ ਅਤੇ ਸ਼ਿਲਪਕਾਰੀ ਅ ਸਿਖਾਉਣ ਦੇ ਕਈ ਤਰ੍ਹਾਂ ਦੇ ਮੈਥਡ ਹੁੰਦੇ ਨੇ ਜਿਵੇਂ ਕ ਕਈ ਵਾਰ ਟੀਚਰ ਜਿਹੜੇ ਹੈਗੇ ਨੇ ਉਹ ਉਹਦੇ ਨਾਲ ਬਹਿੰਦੇ ਨੇ ਅਤੇ ਉਹਨਾਂ ਨੂੰ ਦੱਸਦੇ ਨੇ ਕਿ ਕਿਵੇਂ ਜਿਹੜਾ ਹੈਗਾ ਇੱਕ ਕਾਗਜ਼ ਤੋਂ ਕਿਸ਼ਤੀ ਬਣਾਈ ਜਾਂਦੀ ਹੈ ਅਤੇ ਕਈ ਵਾਰ ਬਾਹਰ ਤੋਂ ਜਿਹੜੇ ਹੈਗੇ ਟੀਚਰ ਉਹ ਵੀ ਪ੍ਰੋਵਾਈਡ ਕੀਤੇ ਜਾਂਦੇ ਨੇ ਉਹਨਾਂ ਨੂੰ ਅਤੇ ਕਈ ਵਾਰੀ ਬੱਚੇ ਆਪਸ ਦੇ ਵਿੱਚ ਹੀ ਇੱਕ ਦੂਜੇ ਨਾਲ ਰਲ ਮਿਲ ਕੇ ਚੀਜ਼ਾਂ ਬਣਾਉਂਦੇ ਨੇ ਅਤੇ ਇੱਕ ਦੂਜੇ ਨਾਲ ਸਿੱਖਦੇ ਨੇ ਕਿ ਇੱਕ ਚੀਜ਼ ਨੂੰ ਕਿਵੇਂ ਬਣਾਈ ਦਾ ਹੁੰਦਾ ਅਤੇ ਅੱਜ ਕੱਲ੍ਹ ਦਾ ਜਿਵੇਂ ਇੰਟਰਨੈਟ ਅਤੇ ਸੋਸ਼ਲ ਮੀਡੀਆ ਬਹੁਤ ਹੀ ਜ਼ਿਆਦਾ ਅਪਡੇਟ ਹੋ ਚੁੱਕਿਆ ਹੈ ਅਤੇ ਜਿਹੜੇ ਬੱਚੇ ਨੇ ਉਹ ਵੀ ਡਿਜੀਟਲ ਅਸੈਸ ਜਿਹੜਾ ਸਿੱਖ ਚੁੱਕੇ ਨੇ ਉਹਨਾਂ ਨੂੰ ਵੀ ਪਤਾ ਆ ਕਿ ਫੋਨ ਦੀ ਵਰਤੋਂ ਕਿਵੇਂ ਹੁੰਦੀ ਹੈ ਅਤੇ ਇਸ ਲਈ ਜਿਹੜਾ ਸੋਸ਼ਲ ਮੀਡੀਆ ਹੈ ਉਹ ਬਹੁਤ ਹੀ ਰੋਲ ਵੱਡਾ ਰੋਲ ਪਲੇ ਕਰਦਾ ਇਹਦੇ ਵਿੱਚ ਅਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਬੱਚੇ ਨੇ ਫੋਨ ਤੋਂ ਜ਼ਿਆਦਾ ਜਲਦੀ ਸਿੱਖਦੇ ਨੇ ਅੱਜ ਕੱਲ੍ਹ ਕਿਉਂਕਿ ਉਹਨਾਂ ਦਾ ਜਿਹੜਾ ਫੋਨ ਨਾਲ ਫੋਨ ਚਲਾਉਣ ਦਾ ਜਿਹੜਾ ਰੁਝਾਨ ਆ ਉਹ ਬਹੁਤ ਜ਼ਿਆਦਾ ਵੱਧ ਗਿਆ ਅਤੇ ਟੀਚਰ ਹੋ ਗਏ ਜਾਂ ਫਿਰ ਸਕੂਲ ਦੇ ਵਿੱਚ ਜਾਂ ਫਿਰ ਜਿਹੜਾ ਹੈਗਾ ਕਦ ਕਿਤੇ ਕਿਤੇ ਅੱਜ ਕੱਲ੍ਹ ਇੰਨੀ ਜ਼ਿਆਦਾ ਅ ਟੈਕਨੋਲੋਜੀ ਆ ਚੁੱਕੀ ਆ ਕਿ ਸਕੂਲਜ਼ ਦੇ ਵਿੱਚ ਹੀ ਫੋਨ ਦੇ ਥਰੂ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਕਿਵੇਂ ਕੋਈ ਚੀਜ਼ ਹੈ ਉਹਨੂੰ ਕਿਵੇਂ ਬਣਾਇਆ ਜਾਂਦਾ ਅਤੇ ਕਿਵੇਂ ਨਹੀਂ ਬਣਾਇਆ ਜਾਂਦਾ ਹੈਗਾ ਅਤੇ ਮੈਨੂੰ ਲੱਗਦਾ ਕਿ ਇਹ ਬਹੁਤ ਹੀ ਵੱਡੀ ਟੈਕਨੋਲਜੀ ਆ ਅਤੇ ਅੱਛੀ ਗੱਲ ਵੀ ਹੈ ਅਤੇ ਮੇਰੇ ਕੋਲ ਜਿਹੜੀ ਹੈਗੀ ਆ ਆਪਣੇ ਬਚਪਨ ਦੀ ਇੱਕ ਯਾਦ ਹੈ ਜਦੋਂ ਮੀਹ ਪੈਂਦਾ ਸੀ ਜੀ ਅਸੀਂ ਜਿਹੜੇ ਹੈਗੇ ਆ ਕਿਸ਼ਤੀਆਂ ਹੁੰਦੀਆਂ ਸੀ ਕਾਗਜ਼ਾਂ ਦੀਆਂ ਉਹਨੂੰ ਬਣਾ ਬਣਾ ਕੇ ਅਸੀਂ ਜਿਹੜਾ ਹੈ ਪਾਣੀ ਦੇ ਵਿੱਚ ਛੱਡਦੇ ਹੁੰਦੇ ਸੀਗੇ ਅਤੇ ਉਹਦੇ ਨਾਲ ਪਿੱਛੇ ਪਿੱਛੇ ਚਲਦੇ ਹੁੰਦੇ ਸੀ ਜਦੋਂ ਤੱਕ ਕਿ ਉਹ ਡੁੱਬ ਨਾ ਜਾਏ ਜਾਂ ਫਿਰ ਉਹ ਖ਼ਰਾਬ ਨਾ ਹੋ ਜਾਏ ਅਤੇ ਮੈਨੂੰ ਉਹ ਵੀ ਆ ਯਾਦ ਹੈ ਕਿ ਮੈਂ ਗੁੱਡੀਆਂ ਦੇ ਜਿਹੜੇ ਹੈਗੇ ਕੱਪੜੇ ਬਣਾਉਣਾ ਜਿਵੇਂ ਗੁੱਡੀਆਂ ਦੇ ਮੈਂ ਤਰ੍ਹਾਂ ਤਰ੍ਹਾਂ ਦੇ ਕੱਪੜੇ ਬਣਾਉਂਦੀ ਸੀ ਮੈਂ ਗੁੱਡੀਆਂ ਵੀ ਬਣਾਈਆਂ ਨੇ ਕਈ ਤਰ੍ਹਾਂ ਦੀ ਮੈਂ ਕਈ ਤਰ੍ਹਾਂ ਦੇ ਮਿੱਟੀ ਦੇ ਜਿਹੜੇ ਹੈਗੇ ਖਿਡੌਣੇ ਵੀ ਬਣਾਏ ਨੇ ਮੇਰੀਆਂ ਜਿਹੜੇ ਯਾਦਾਂ ਨੇ ਬੜੀ ਚੰਗੀਆਂ ਨੇ ਅਤੇ ਮੈਂ ਹਮੇਸ਼ਾ ਯਾਦ ਵੀ ਕਰਦੀ ਹਾਂ ਇਹਨਾਂ ਨੂੰ ਅਤੇ ਹੁਣ ਵੀ ਮੈਂ ਕਦੇ ਕਦੇ ਅ ਕਰ ਲੈਂਦੀ ਹਾਂ ਜਿਵੇਂ ਕਿਸ਼ਤੀ ਬਣਾਉਣਾ ਕਦੇ ਕਾਗਜ਼ਾਂ ਦੇ ਜਹਾਜ਼ ਬਣਾ ਕੇ ਉਡਾ ਦੇਣਾ ਕਈ ਤਰ੍ਹਾਂ ਦੀਆਂ ਚੀਜ਼ਾਂ ਨੇ ਮੇਰੀਆਂ ਦਿਮਾਗ ਦੇ ਵਿੱਚ ਹੁਣ ਵੀ ਮੇਰੇ ਦਿਲ 'ਚ ਵਸੀਆਂ ਹੋਈਆਂ ਨੇ ਯਾਦਾਂ ਅਤੇ ਮੈਂ ਹੁਣ ਵੀ ਕਰਦੀ ਹਾਂ ਜੇ ਪਰ ਲੇਕਿਨ ਬਚਪਨ ਦੀਆਂ ਜਿਹੜੀਆਂ ਯਾਦਾਂ ਨੇ ਬਹੁਤ ਸਾਰੀਆਂ ਨੇ ਅਤੇ ਉਹਨਾਂ ਨੂੰ ਇੱਕ ਵਾਕ ਦੇ ਵਿੱਚ ਸਮੇਟਣਾ ਬਹੁਤ ਹੀ ਮੇਰੇ ਲਈ ਬਹੁਤ ਮੁਸ਼ਕਿਲ ਹੈ ਪਰ ਇਹਦੇ ਵਿੱਚ ਕੁਝ ਜਿਹੜੀਆਂ ਮ ਯਾਦਾਂ ਨੇ ਮੈਂ ਬਹੁਤ ਦਿਲ ਦੇ ਕਰੀਬ ਨੇ ਉਹ ਹੈਗੀਆਂ ਨੇ ਜਿਵੇਂ ਗੁੱਡੀਆਂ ਨੂੰ ਬਣਾਉਣਾ ਅਤੇ ਮਿੱਟੀ ਦੇ ਖਿਡੋਣੇ ਬਣਾਉਣਾ ਕਿਸ਼ਤੀਆਂ ਬਣਾਉਣਾ ਜਹਾਜ ਬਣਾਉਣਾ ਅਤੇ ਕਈ ਹੋਰ ਤਰ੍ਹਾਂ ਦੇ ਜਿਹੜੇ ਹੈਗੇ ਸੀ ਮੈਂ ਛੋਟੇ ਮੋਟੇ ਆਰਟ ਐਂਡ ਕਰਾਫਟ ਦੀ ਜਿਹੜੀਆਂ ਕੁਝ ਚੀਜ਼ਾਂ ਕਰਦੀ ਸੀ ਜਿਵੇਂ ਮੈਂ ਵੇਸਟ ਮਟੀਰੀਅਲ ਤੋਂ ਗ ਗਰੇਪਸ ਬਣਾਏ ਨੇ ਮੈਂ ਇੱਕ ਵੇਸਟ ਮਟੀਰੀਅਲ ਤੋਂ ਆਪਣਾ ਜਿਹੜਾ ਹੈਗਾ ਪੈੱਨ ਸਟੈਂਡ ਬਣਾਇਆ ਮੇਰੇ ਕਈ ਤਰ੍ਹਾਂ ਦੇ ਯਾਦਾਂ ਨੇ ਜਿਹੜੀਆਂ ਮੈਂ ਹੁਣ ਵੀ ਮੇਰੇ ਦਿਲ ਦੇ ਵਿੱਚ ਵਸੀਆਂ ਹੋਈਆਂ ਨੇ